ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਛਾਇਆ ਗਾਰਮੈਂਟਸ ਤੋਂ ਗੱਲ ਕਰ ਰਹੇ ਜੀ ਭਾਅ ਜੀ ਮੈਂ ਪਿਛਲੇ ਹਫਤੇ ਮਿੰਤਰਾਂ ਤੋਂ ਇੱਕ ਟੀ ਸ਼ਰਟ ਔਡਰ ਕੀਤੀ ਸੀ ਜੀ ਮਾਸਟ ਐਡ ਹਾਰਬਰ ਦੀ ਜੋ ਤੁਹਾਡੀ ਸ਼ੋਪ ਤੋਂ ਸਪਲਾਈ ਹੋਈ ਸੀ ਅਤੇ ਭਾਅ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਤੁਹਾਡੀ ਜੋ ਕੁਆਲਿਟੀ ਹੈ ਟੀ ਸ਼ਰਟ ਦੀ ਬਹੁਤ ਪਸੰਦ ਆਈ ਤੁਹਾਡੇ ਪ੍ਰੋਡਕਟ ਬਹੁਤ ਵਧੀਆ ਹੈ ਜੀ ਅਤੇ ਉਸਦੀ ਜੋ ਫੀਟਿੰਗ ਸੀ ਉਹ ਵੀ ਬਿਲਕੁਲ ਸਹੀ ਹੈ ਅਤੇ ਰੰਗ ਵੀ ਬਹੁਤ ਵਧੀਆ ਹੈ ਅਤੇ ਕਿਤੋਂ ਵੀ ਤੁਹਾਡਾ ਪੀਸ ਡਿਫੈਕਟਡ ਨਹੀਂ ਹੈਗਾ ਅਤੇ ਤੁਹਾਡੀ ਡਿਲੀਵਰੀ ਵੀ ਬਹੁਤ ਟਾਈਮ ਸਿਰ ਮਿਲੀ ਮੈਨੂੰ ਅਤੇ ਤੁਹਾਡੀ ਜੋ ਪੈਕੇਜਿੰਗ ਸੀਗੀ ਉਹ ਵੀ ਬਹੁਤ ਵਧੀਆ ਸੀ ਮੈਨੂੰ ਬਹੁਤ ਪਸੰਦ ਆਈ ਤੁਹਾਡੀ ਟੀ ਸ਼ਰਟ ਦੀ ਕੁਆਲਿਟੀ ਅਤੇ ਮੈਂ ਹੋਰ ਵੀ ਅੱਗੇ ਹੋਰ ਵੀ ਪ੍ਰੋਡਕਟਸ ਆਰਡਰ ਕਰਾਂਗੀ ਤੁਹਾਡੇ ਸ਼ੋਪ ਤੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ